ਜਲੰਧਰ ਸ਼ਹਿਰ ਪੰਜਾਬ ਦੇ ਬਿਲਕੁਲ ਲਗਭਗ ਵਿੱਚ ਵਿਚਾਲੇ ਹੋਣ ਦੇ ਕਾਰਨ ਇਹ ਮੈਡੀਕਲ ਫੈਸਿਲਿਟੀਜ਼ ਵਾਸਤੇ ਅਤੇ ਹੋਰ ਬਥੇਰੀਆਂ ਚੀਜ਼ਾਂ ਵਾਸਤੇ ਜਾਣਿਆ ਜਾਂਦਾ ਇਸ ਜਗ੍ਹਾ ਦੇ ਉੱਪਰ ਕਿੱਤੇ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੇਰਨਾ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਲੰਧਰ ਜ਼ਿਲ੍ਹਾ ਬਹੁਤ ਮਸ਼ਹੂਰ ਹੈ ਖੇਡਾਂ ਦੇ ਸਮਾਨ ਦੀ ਉਤਪਾਦਨ ਲਈ ਅਤੇ ਨਾਲ ਦੇ ਨਾਲ ਹੀ ਚਮੜੇ ਦੇ ਉਤਪਾਦਾਂ ਦੇ ਲਈ ਤੋ ਇਹਨਾਂ ਦੋਨਾਂ ਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਸ਼ਹਿਰ ਦੇ ਵਿੱਚ ਹੀ ਅਗਰ ਆਪਾਂ ਗੱਲ ਕਰੀਏ ਤਾਂ ਇੱਥੇ ਕਾਫ਼ੀ ਜ਼ਿਆਦਾ ਆਈ ਟੀ ਆਈ ਅਤੇ ਪੋਲੀਟੈਕਨਿਕ ਹਨ ਜਿੱਥੋਂ ਲੋਕ ਆਪਣੀ ਟੈਕਨੀਕਲ ਜਿਹੜੀ ਸ ਸਕਿਲ ਹੈ ਉਹਨੂੰ ਬਣਾ ਕੇ ਇੱਥੇ ਜਲੰਧਰ ਸ਼ਹਿਰ ਦੇ ਵਿੱਚ ਹੀ ਜੋਬ ਕਰ ਸਕਦੇ ਹਨ ਇਸ ਦੇ ਫ਼ਾਇਦੇ ਇਕੱਲੇ ਉਸ ਬੱਚੇ ਨੂੰ ਨਹੀਂ ਹੈ ਜਿਹਨੂੰ ਇੱਥੇ ਨੌਕਰੀ ਮਿਲ ਜਾਂਦੀ ਹੈ ਬਲਕਿ ਉਸ ਬੱਚੇ ਦੇ ਇੱਥੇ ਨੌਕਰੀ ਕਰਨ ਦੇ ਨਾਲ ਇੱਥੋਂ ਦੀਆਂ ਜਿਹੜੀ ਇੰਡਸਟਰੀ ਹੈ ਉਹ ਅੱਛੇ ਤਰੀਕੇ ਦੇ ਨਾਲ ਵੱਧ ਫੁੱਲ ਰਹੀ ਹੈ ਜਿਸ ਕਾਰਨ ਜਿਹੜਾ ਪੈਸਾ ਹੈ ਜਾਂ ਜਿਹੜਾ ਜਿਲ੍ਹੇ ਦਾ ਵਿਕਾਸ ਹੈ ਉਹ ਹੋਰ ਜ ਜਿਹੜਾ ਹੈ ਵਧੀਆ ਸਪੀਡ ਦੇ ਨਾਲ ਹੋ ਰਿਹਾ ਹੈ ਵਧੀਆ ਗਤੀ ਦੇ ਨਾਲ ਵਿਕਾਸ ਹੋ ਰਿਹਾ ਹੈ ਇੱਥੇ ਐਜੂਕੇਸ਼ਨ ਦੇ ਹਾਲਾਤ ਦੇਖੇ ਜਾਣ ਤਾਂ ਚਾਰ ਯੂਨੀਵਰਸਿਟੀਜ਼ ਨੇ ਜਿਹੜੀਆਂ ਜਲੰਧਰ ਜ਼ਿਲ੍ਹੇ ਦੇ ਵਿੱਚ ਨੇ ਜਿੱਥੋਂ ਲੋਕ ਆਪਣੀ ਸਿੱਖਿਆ ਦਾ ਮਿਆਰ ਜਿਹੜਾ ਨਾ ਉਹ ਵਧੀਆ ਉੱਚਾ ਚੁੱਕ ਸਕਦੇ ਨੇ ਅਤੇ ਇਸੇ ਯੂਨੀਵਰਸਿਟੀ ਦੇ ਵਿੱਚੋਂ ਪੜ੍ਹ ਲਿਖ ਕੇ ਲੋਕ ਜਿਹੜੇ ਨੇ ਉਹ ਅਫਸਰ ਬਣ ਰਹੇ ਨੇ ਜਿਹਦੇ ਨਾਲ ਜਲੰਧਰ ਦਾ ਨਾਮ ਰੌਸ਼ਨ ਹੋ ਰਿਹਾ ਅਤੇ ਓਵਰਆਲ ਜ਼ਿਲ੍ਹੇ ਦੀ ਜਿਹੜੀ ਸਮੁੱਚੀ ਗਤੀ ਹੈ ਗਤੀ ਦੇ ਨਾਲ ਉਹ ਪ੍ਰੋਗਰੈਸ ਕਰ ਰਿਹਾ